ਹੈਲੋ ਜਸ਼ਨ ਤੂੰ ਕਿਵੇਂ ਹੈ ਮੈਂ ਤੇਰੇ ਤੋਂ ਇਹ ਪੁੱਛਣਾ ਸੀ ਕਿ ਮੈਂ ਪਟਿਆਲੇ ਦੇ ਕ੍ਰਾਫਟ ਮੇਲਾ ਵੇਖਣ ਜਾਣਾ ਸੀ ਕੀ ਤੂੰ ਮੈਨੂੰ ਕੋਈ ਸੁਜੈਸ਼ਨ ਕਰ ਸਕਦੀ ਹੈ ਕਿ ਮੈਂ ਕੈਬ 'ਤੇ ਜਾਵਾਂ ਜਾਂ ਫਿਰ ਔਟੋ ਜਾਂ ਫਿਰ ਬੱਸ 'ਤੇ ਦੇਖਣ ਜਾਵਾਂ ਮੇਲਾ ਜੇਕਰ ਕੋਈ ਤੇਰੇ ਕੋਲ ਵਧੀਆ ਕੈਬ ਵਾਲੇ ਦਾ ਨੰਬਰ ਹੈ ਤਾਂ ਤੂੰ ਮੈਨੂੰ ਸੈਂਡ ਕਰਦੀ ਜਿਸ ਦੇ ਨਾਲ ਮੈਂ ਕ੍ਰਾਫਟ ਮੇਲਾ ਵੇਖ ਸਕਾਂ ਓਕੇ ਜਸ਼ਨ ਆਪਣਾ ਧਿਆਨ ਰੱਖੀਂ ਬਾਏ